ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਬਹੁਤ ਫਰਕ ਹੈ ਜਿਹੜੇ ਪੁਰਾਣੇ ਗੀਤ ਸੀ ਉਹ ਸੱਭਿਆਚਾਰਕ ਸੀ ਅਤੇ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕਦੇ ਸਾਂ ਅਤੇ ਉਹਨਾਂ ਗੀਤਾਂ ਦੇ ਵਿੱਚ ਕਿ ਜਿਵੇਂ ਉਹਨਾਂ ਨੇ ਪੂਰੇ ਕੱਪੜੇ ਪਾਏ ਹੁੰਦੇ ਸੀ ਚੱਜ ਦੇ ਸਲਵਾਰ ਸੂਟ ਪਾਏ ਹੁੰਦੇ ਸੀ ਅਤੇ ਸਿਰਾਂ 'ਤੇ ਚੁੰਨੀਆਂ ਲਈਆਂ ਹੁੰਦੀਆਂ ਸੀ ਅਤੇ ਜਿਹੜੇ ਅੱਜ ਦਾ ਸਮਾਂ ਅੱਜ ਦੇ ਗੀਤਾਂ ਦੇ ਵਿੱਚ ਅੱਧੇ ਅੱਧੇ ਕੱਪੜੇ ਪਾਏ ਹੁੰਦੇ ਆ ਨਿੱਕੇ ਨਿੱਕੇ ਅਤੇ ਉਹਨਾਂ ਦਾ ਨਾ ਕੋਈ ਮਤਲਬ ਨਿਕਲਦਾ ਗਾਣਿਆਂ ਦਾ ਬਸ ਉਹ ਐਵੇਂ ਹੀ ਲੋਕ ਸੱਭਿਆਚਾਰ ਜਿਹੜਾ ਵਾ ਉਹਨੂੰ ਖਰਾਬ ਕਰਨ ਲਈ ਨੇ ਅਤੇ ਪਰ ਮੈਨੂੰ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਪੁਰਾਣੇ ਗੀਤ ਪਸੰਦ ਨੇ ਕਿਉਂਕਿ ਉਹ ਮੈਂ ਪਰਿਵਾਰ ਵਿੱਚ ਬਹਿ ਕੇ ਸੁਣਦੀ ਹਾਂ ਨਾਲ ਪਰਿਵਾਰ ਦੇ ਨਾਲ ਬਹਿ ਕੇ ਸੁਣਨ ਦਾ ਮਜ਼ਾ ਹੀ ਵੱਖਰਾ ਹੈ ਅਸੀਂ ਸਾਰਾ ਪਰਿਵਾਰ ਬੈਠ ਕੇ ਸੁਣਦੇ ਹਾਂ ਅਤੇ ਉਸਦਾ ਆਨੰਦ ਮਾਣਦੇ ਹਾਂ ਪਰ ਜਿਹੜੇ ਅੱਜ ਦੇ ਗੀਤ ਨੇ ਉਹਨਾਂ ਨੂੰ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਨਹੀਂ ਸੁਣ ਸਕਦੇ ਅਤੇ ਅੱਜ ਦੇ ਜਿਵੇਂ ਬਾਹਰ ਦੇ ਲੋਕਾਂ ਨੂੰ ਵੇਖ ਵੇਖ ਕੇ ਲੋਕ ਉਹੀ ਚੀਜ਼ਾਂ ਇੱਥੇ ਕਰਨ ਲੱਗ ਗਏ ਨੇ ਅਤੇ ਆਪਣੇ ਸੱਭਿਆਚਾਰ ਨੂੰ ਖਰਾਬ ਕਰ ਰਹੇ ਨੇ